ਹੈਲੋ

ਹਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਂ ਐਕਚੁਅਲੀ ਰੀਅਲ ਸਟੇਸ ਬਾਰੇ ਹੀ ਪੁੱਛਣਾ ਸੀ ਤੁਹਾਡੇ ਤੋਂ ਅਤੇ ਮੈਂ ਹੁਣ ਜਿਵੇਂ ਸਰਹਿੰਦ 'ਚ ਰਹਿਦੀ ਹਾਂ ਅਤੇ ਮੈਂ ਕੋਈ ਜਿਵੇਂ ਵੱਡਾ ਸ਼ਹਿਰ ਉਹਦੇ ਅੰਦਰ ਸ਼ਿਫਟ ਕਰਨਾ ਚਾਹ ਰਹੀ ਹਾਂ ਜਿਵੇਂ ਲੁਧਿਆਣਾ ਹੋ ਗਿਆ ਜਾਂ ਮੋਹਾਲੀ ਵਾਲਾ ਏਰੀਆ ਹੋ ਗਿਆ ਤੇ ਮੈਨੂੰ ਹੁਣ ਵੈਸੇ ਤਾਂ ਮੋਹਾਲੀ ਦੇ ਕੋਲ ਹੀ ਘਰ ਚਾਹੀਦਾ ਕਿਉਂਕਿ ਮੈਂ ਉੱਥੇ ਕੰਮ ਕਰ ਰਹੀ ਹਾਂ ਜੇ ਫਲੈਟ ਹੋਵੇ ਤਾਂ ਜ਼ਿਆਦਾ ਬੈਟਰ ਐ ਕਿਉਂਕਿ ਮੈਂ ਹੁਣ ਜਿਵੇਂ ਕੰਪਨੀ ਜੇ ਬਾਅਦ 'ਚ ਚੇਂਜ ਕਰਨੀ ਹੋਵੇ ਤਾਂ ਮੈਨੂੰ ਫਲੈਟ ਜਿਵੇਂ ਬਾਅਦ 'ਚ ਦੇਣਾ ਫਿਰ ਸੌਖਾ ਲੱਗੇਗਾ ਨਾ ਤਾਂ ਤੁਸੀਂ ਮੈਨੂੰ ਕੋਈ ਵੀ ਅਤੇ ਹਾਂਜੀ ਜਿਵੇਂ ਜਿਹੜਾ ਤੁਸੀਂ ਫਲੈਟ ਬਾਰੇ ਦੱਸ ਰਹੇ ਹੋ ਉਹਦੇ ਅੰਦਰ ਬਾਲਕਨੀ ਕਿੰਨੀ ਕੁ ਬੜੀ ਹੋਵੇਗੀ

ਠੀਕ ਹੈ ਅਤੇ ਕਾਰ ਖੜਨ ਅ ਖਾ ਅ ਜਿਹੜੀ ਕਾਰ ਆ ਉਹਦੀ ਪਾਰਕਿੰਗ ਸਪੇਸ ਠੀਕ ਹੈ ਅਤੇ ਜਿਵੇਂ ਜਿਹੜਾ ਏਰੀਆ ਉਹਦੇ ਅੰਦਰ ਕੋਈ ਜਿਵੇਂ ਗਾਰਡਨ ਜਾਂ ਪਾਰਕ ਵਗੈਰਾ ਬਣੇ ਹੋਏ ਨੇ ਜਿਵੇਂ ਜਿਹੜੇ ਸਵੇਰੇ ਸਵੇਰੇ ਸੈਰ ਕਰਨੀ ਹੋਵੇ ਜਾਂ ਸ਼ਾਮ ਨੂੰ ਜਿਵੇਂ ਕਿਸੇ ਨੇ ਬਾਹਰ ਜਾਣਾ ਹੋਵੇ ਤਾਂ ਠੀਕ ਹੈ ਜੀ ਮੈਂ ਫਿਰ ਤੁਸੀਂ ਮੈਨੂੰ ਦੱਸਦੋ ਤੁਸੀਂ ਕਦੋਂ ਫਰੀ ਹੋ ਅਤੇ ਤੁਸੀਂ ਮੈਨੂੰ ਜਗ੍ਹਾ ਦਿਖਾ ਦਿਓ ਫਿਰ ਆਪਾਂ ਅੱਗੇ ਦੇਖ ਲਾਂਗੇ ਕਿਵੇਂ ਜਿਵੇਂ ਡੋਕੂਮੈਂਟਸ ਵਗੈਰਾ ਪ੍ਰੀਪੇਅਰ ਕਰਨੇ ਨੇ